ਜਿਵੇਂ ਕਿ ਮੈਨੂੰ ਪਾਲਤੂ ਜਾਨਵਰ ਬਿਲਕੁਲ ਨਹੀਂ ਪਸੰਦ ਹਨ ਅਤੇ ਨਾ ਹੀ ਮੈਨੂੰ ਪਾਲਤੂ ਜਾਨਵਰਾਂ ਨੂੰ ਘਰ ਵਿੱਚ ਰੱਖਣਾ ਪਸੰਦ ਹੈ ਕਿਉਂਕਿ ਪਾਲਤੂ ਜਾਨਵਰਾਂ ਉੱਤੇ ਬਹੁਤ ਹੀ ਗੰਦ ਹੁੰਦਾ ਹੈ ਇਸ ਲਈ ਮੈਨੂੰ ਪਾਲਤੂ ਜਾਨਵਰ ਬਿਲਕੁਲ ਨਹੀਂ ਪਸੰਦ ਹਨ ਅਤੇ ਉਹ ਬਹੁਤ ਹੀ ਗੰਦਗੀ ਵਿੱਚ ਰਹਿੰਦੇ ਹਨ ਅਤੇ ਘਰ ਵਿੱਚ ਵੀ ਗੰਦ ਪਾ ਕੇ ਰੱਖਦੇ ਹਨ ਪਾਲਤੂ ਜਾਨਵਰਾਂ ਨੂੰ ਜਿੱਥੇ ਵੀ ਰੱਖੋ ਉਹ ਉੱਥੇ ਹੀ ਗੰਦ ਪਾਉਂਦੇ ਹਨ ਉਹਨਾਂ ਨੂੰ ਨਾ ਹੀ ਖਾਣ ਦਾ ਅਤੇ ਨਾ ਹੀ ਬੈਠਣ ਦਾ ਕੁੱਝ ਵੀ ਨਹੀਂ ਪਤਾ ਹੁੰਦਾ ਇਸ ਲਈ ਮੈਨੂੰ ਪਾਲਤੂ ਜਾਨਵਰਾਂ ਨੂੰ ਆਪਣੇ ਕੋਲ ਰੱਖਣਾ ਆਪਣੇ ਘਰ ਵਿੱਚ ਰੱਖਣਾ ਅਤੇ ਉਹਨਾਂ ਨੂੰ ਦੇਖਣਾ ਵੀ ਬਿਲਕੁਲ ਪਸੰਦ ਨਹੀਂ ਹਨ ਪਾਲਤੂ ਜਾਨਵਰ ਘਰ ਵਿੱਚ ਰੱਖਣ ਨਾਲ਼ ਉਹ ਬਹੁਤ ਹੀ ਗੰਦ ਪਾਉਂਦੇ ਹਨ ਉਹਨਾਂ ਦਾ ਜਿੱਥੇ ਦਿਲ ਕਰਦਾ ਹੈ ਉੱਥੇ ਹੀ ਉਹ ਪਿਸ਼ਾਬ ਕਰ ਦਿੰਦੇ ਹਨ ਅਤੇ ਖਾਣਾ ਪੀਣਾ ਉਹਦੇ ਵਿੱਚ ਵੀ ਉਹ ਬਹੁਤ ਗੰਦਗੀ ਵਰਤਦੇ ਹਨ ਅਗਰ ਉਹਨਾਂ ਨੂੰ ਕੁਝ ਵੀ ਖਾਣ ਲਈ ਪਾਇਆ ਜਾਵੇ ਤਾਂ ਘਰ ਵਿੱਚ ਵੀ ਗੰਦ ਪਾ ਦਿੰਦੇ ਹਨ ਪਾ ਦਿੰਦੇ ਹਨ ਇਸ ਲਈ ਪਾਲਤੂ ਜਾਨਵਰਾਂ ਨੂੰ ਮੈਂ ਰੱਖਣਾ ਬਿਲਕੁਲ ਪਸੰਦ ਨਹੀਂ ਕਰਦੀ ਪਾਲ ਪਾਲਤੂ ਜਾਨਵਰਾਂ ਗੰਦ ਵਿੱਚ ਅਤੇ ਗੰਦਗੀ ਵਿੱਚ ਰਹਿਣਾ ਜ਼ਿਆਦਾ ਪਸੰਦ ਕਰਦੇ ਨੇ ਇਸ ਲਈ ਮੈਨੂੰ ਪਾਲਤੂ ਜਾਨਵਰ ਨਹੀਂ ਪਸੰਦ